ਪੰਜਾਬ ਵਿੱਚ ਹੁਣ ਤਾਂ ਸੈਲਾਨੀ ਬਹੁਤ ਹੀ ਜ਼ਿਆਦਾ ਘੁੰਮਣ ਆਉਂਦੇ ਹਨ ਕਿਤੇ ਵੀ ਜਾਂਦੇ ਹਾਂ ਆਪਾਂ ਉੱਥੇ ਆਪਾਂ ਦੇਖਾਂਗੇ ਆਪਾਂ ਨੂੰ ਵੱਧ ਤੋਂ ਵੱਧ ਸੈਲਾਨੀ ਮਿਲਦੇ ਹਨ ਜਿਵੇਂ ਆਪਾਂ ਇੱਥੇ ਚਲੇ ਜਾਈਏ ਆਪਣਾ ਅੰਮ੍ਰਿਤਸਰ ਚਲੇ ਜਾਈਏ ਉਹ ਤੋਂ ਗਾਹਾਂ ਆਪਣਾ ਬਾਘਾ ਬਾਰਡਰ ਆ ਬਾਘਾ ਬਾਰਡਰ ਵਿੱਚ ਸੈਲਾਨੀ ਬਹੁਤ ਦੇਖਣ ਆਉਂਦੇ ਆ ਜਦੋਂ ਦੇਖਦੇ ਹਾਂ ਕਿ ਜੋ ਪੁੱਛ ਪੁੱਛਦੇ ਉਹਨਾਂ ਨੂੰ ਦੂਰੋਂ ਦੂਰੋਂ ਕੋਈ ਕੇਰਲਾ ਤੋਂ ਆ ਰਿਹਾ ਕੋਈ ਗੋਆ ਤੋਂ ਆ ਰਿਹਾ ਕੋਈ ਬਾਹਰਲੇ ਦੇਸ਼ ਤੋਂ ਵੀ ਆ ਰਹੇ ਹੈ ਉੱਥੇ ਇੰਨੀ ਸੋਹਣੀ ਪਰੇਡ ਹੁੰਦੀ ਹੈ ਪਾਕਿਸਤਾਨ ਦੀ ਅਤੇ ਇੰਡੀਆ ਦੀ ਜਿਹਨੂੰ ਲੋਕ ਦੇਖਣ ਆਉਂਦੇ ਨੇ ਉਸ ਤੋਂ ਬਾਅਦ ਦੇਖ ਦੇਖ ਕੇ ਫਿਰ ਆਪਣਾ ਗੁਰਦੁਆਰਾ ਸਾਹਿਬ ਚਲੇ ਜਾਂਦੇ ਆ ਉੱਥੇ ਦਾ ਦੇਖਦੇ ਨੇ ਕਿ ਕਿੰਨਾ ਸੋਹਣਾ ਅ ਦੋ ਲੱਖ ਬੰਦਿਆਂ ਨੂੰ ਲੰਗਰ ਛਕਾਇਆ ਜਾਂਦਾ ਹੈ ਗੋਲਡਨ ਟੈਂਪਲ 'ਚ ਉੱਥੇ ਕਿ ਕਿੱਦਾਂ ਕਿਚਨ ਚੱਲਦੀ ਹੈ ਉੱਥੇ ਦੁਰਗਿਆਣਾ ਮੰਦਿਰ ਹੈ ਮਤਲਬ ਬਹੁਤ ਹੀ ਇਹ ਸੈਲਾਨੀ ਹੁਣ ਤਾਂ ਪੰਜਾਬ ਵੱਲ ਨੂੰ ਖਿੱਚ ਕਰ ਰਹੇ ਨੇ ਕਿ ਆਪਣੇ ਦੇਸ਼ ਵੱਲ ਨੂੰ ਇਸ ਲਈ ਵੱਧ ਤੋਂ ਵੱਧ ਆ ਰਹੇ ਨੇ ਇੱਥੇ ਆਪਣੇ ਦੇਖਣ ਵਾਸਤੇ ਕੀ ਆ ਇਹ ਚੀਜ਼ਾਂ ਬਹੁਤ ਹੀ ਦੇਖਣ ਵਾਸਤੇ ਵਧੀਆ ਨੇ